ਜੀ ਹਾਂ ਮੈਨੂੰ ਸ਼ੁਰੂ ਤੋਂ ਹੀ ਗਾਇਕੀ ਦਾ ਬਹੁਤ ਸ਼ੌਂਕ ਰਿਹਾ ਹੈ ਅਤੇ ਹੁਣ ਵੀ ਉਹ ਸ਼ੌਂਕ ਮੇਰੇ ਦਿਲ ਵਿੱਚ ਹੈ ਮੈਂ ਆਪਣੇ ਭਵਿੱਖ ਵਿੱਚ ਆਪਣੇ ਗਾਉਣ ਲਈ ਕੁਝ ਇੱਛਾਵਾਂ ਤੁਹਾਡੇ ਸਾਹਮਣੇ ਵਿਅਕਤ ਕਰਨਾ ਚਾਹੁੰਦੀ ਹਾਂ ਮੈਂ ਗਾਇਕੀ ਨੂੰ ਬਹੁਤ ਹੀ ਗਹਿਰਾਈ ਨਾਲ ਸਿੱਖਣਾ ਚਾਹੁੰਦੀ ਹਾਂ ਅਤੇ ਮੈਂ ਹਜੇ ਵੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੀ ਗਾਇਕੀ ਨੂੰ ਵੱਧ ਤੋਂ ਵੱਧ ਸੁਧਾਰ ਸਕਾਂ ਅਤੇ ਇਸ 'ਤੇ ਮੈਂ ਆਪਣਾ ਭਵਿੱਖ ਬਣਾ ਸਕਾਂ ਗਾਇਕੀ ਨਾਲ ਮੇਰੇ ਮਨ ਨੂੰ ਵੀ ਸਕੂਨ ਮਿਲਦਾ ਹੈ ਅਤੇ ਮੈਂ ਆਪਣੇ ਭਵਿੱਖ ਵਿੱਚ ਗਾਇਕੀ ਨਾਲ ਸੰਬੰਧਿਤ ਕੁਝ ਨਾ ਕੁਝ ਜ਼ਰੂਰ ਕਰਾਂਗੀ ਧੰਨਵਾਦ